ਮੈਂ ਗਿਆਰ੍ਹਾਂ ਮਾਰਚ ਦੋ ਹਜ਼ਾਰ ਪੱਚੀ ਨੂੰ ਔਨਲਾਈਨ ਜਾ ਕੇ ਇੱਕ ਰੇਲਵੇ ਦੀ ਟਿਕਟ ਬੁੱਕ ਕਰਵਾਈ ਸੀ ਜਿੱਥੇ ਮੈਂ ਲੁਧਿਆਣੇ ਤੋਂ ਅੰਮ੍ਰਿਤਸਰ ਜਾਣਾ ਸੀ ਮੈਨੂੰ ਇਸ ਦਾ ਕੋਈ ਮੈਸੇਜ ਨਹੀਂ ਆਇਆ ਨਾ ਹੀ ਮੈਨੂੰ ਇਹਦਾ ਕੋਈ ਟਿਕਟ ਆਈ ਆ ਪੈਸੇ ਵੀ ਮੈਂ ਪੇ ਕਰ ਚੁੱਕੀ ਹਾਂ ਮੇਰੇ ਕੋਲ ਐ ਡੀ ਨੰਬਰ ਵੀ ਹੈਗਾ ਆ ਪਰ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਮੈਂ ਇਹ ਟਿਕਟ ਬੁੱਕ ਕਰਵਾਈ ਹੈ ਹੋਈ ਹੈ ਜਾਂ ਨਹੀਂ ਅਤੇ ਇਹਦੀ ਇਹ ਹੀ ਇਹ ਹੀ ਮੈਂ ਜਾਨਣਾ ਚਾਹੁੰਦੀ ਹਾਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਤੁਸੀਂ ਮੈਨੂੰ ਇਸ ਇਹ ਦੱਸ ਸਕਦੇ ਹੋ ਕਿ ਟਿਕਟ ਬੁੱਕ ਹੋ ਗਈ ਹੈ ਜਾਂ ਨਹੀਂ ਕਿਉਂਕਿ ਫਲਾਈਟ ਮਿਤੀ ਮਿਤੀ ਸੋਲ੍ਹਾਂ ਤਰੀਕ ਸੀਗੀ ਅਤੇ ਅੱਜ ਹੈਗੀ ਆ ਅਤੇ ਚੌਦ੍ਹਾਂ ਤਰੀਕ ਮੈਨੂੰ ਇਹਨਾਂ ਦਾ ਕੈਨ ਕੰਨਫਿਊਜ਼ਨ ਆ ਕਿ ਮੇਰਾ ਹੋਵੇਗਾ ਕਿ ਨਹੀਂ ਜੇ ਨਹੀਂ ਹੋਵੇਗਾ ਤਾਂ ਫਿਰ ਮੈਂ ਉਹਦੀ ਕੰਪਲੇਂਟ ਕਿੱਥੇ ਕਰਾਂ ਅਤੇ ਦੱਸ ਦਿਓ ਮੈਨੂੰ ਅਤੇ ਐ ਡੀ ਨੰਬਰ ਹੈਗਾ ਆ ਪਰਮਜੀਤ ਕੌਰ ਐਡ ਦੀ ਰੇਟ ਵਨ ਟੂ ਅਤੇ ਇਹ ਹੀ ਆਈ ਡੀ 'ਤੇ ਮੈਂ ਦੂਜਾ ਬੁਕਿੰਗ ਕਰਵਾਉਣ ਵਾਸਤੇ ਜੋ ਕਰ ਸਕਦੀ ਹਾਂ ਕਿਰਪਾ ਕਰਕੇ ਮੈਨੂੰ ਜਲਦੀ ਤੋਂ ਜਲਦੀ ਇਹਦਾ ਜਵਾਬ ਦਿੱਤਾ ਜਾਵੇ